ਹਾਂਜੀ ਮੇਰੀ ਸਭ ਤੋਂ ਦਿਲਚਸਪ ਜਗ੍ਹਾ ਹੈਗੀ ਏ ਵਰਿੰਦਾਵਨ ਜਿਹਦੇ ਮੈਂ ਗਈ ਹਾਂ ਅਤੇ ਉੱਥੇ ਮੈਨੂੰ ਜਾ ਕੇ ਬੜਾ ਹੀ ਅੱਛਾ ਲੱਗਾ ਹੈ ਕਿ ਇੱਕ ਤਾਂ ਸ਼੍ਰੀ ਕ੍ਰਿਸ਼ਨ ਜੀ ਜਨ ਦੀ ਜੀ ਦੀ ਜਨਮ ਧਰਤੀ ਹੈ ਅਤੇ ਉੱਥੇ ਜਾ ਕੇ ਤੁਹਾਨੂੰ ਸਾਰਾ ਹੀ ਇੱਕ ਰਸ ਜਿਹਾ ਹੀ ਮਹਿਸੂਸ ਹੁੰਦਾ ਹਰ ਕੋਈ ਕ੍ਰਿਸ਼ਨ ਭਗਤੀ 'ਚ ਡੁੱਬਿਆ ਹੁੰਦਾ ਰਾਧੇ ਰਾਧੇ ਕਰਦਾ ਔਰ ਵਿਦੇਸ਼ੀ ਵੀ ਆ ਕੇ ਸਾਡੇ ਹੀ ਰੰਗ 'ਚ ਰੰਗੇ ਹੁੰਦੇ ਆ ਫਿਰ ਉੱਥੋਂ ਦੀ ਸਭ ਤੋਂ ਵੱਡੀ ਇੱਕ ਚੀਜ਼ ਜਿਹੜੀ ਹੈਗੀ ਹੈ ਉੱਥੋਂ ਦਾ ਨਿਧੀ ਵਨ ਜਿਹੜਾ ਹੈਗਾ ਜੰਗਲ ਜਿਹਦੇ ਬਾਰੇ ਮੈਂ ਬਹੁਤ ਸੁਣਿਆ ਸੀ ਪੜ੍ਹਿਆ ਵੀ ਸੀ ਅਖਬਾਰਾਂ 'ਚ ਹੋਰ ਵੀ ਨਿਊਜ਼ ਪੇਪਰ 'ਚ ਵੀ ਸੁਣਿਆ ਨਿਊਜ਼ ਪੇਪਰ 'ਚ ਵੀ ਪੜ੍ਹਿਆ ਉਹਦੇ ਬਾਰੇ ਮੈਂ ਬੜੀ ਹੈਰਾਨ ਕਰਨ ਵਾਲੀਆਂ ਗੱਲਾਂ ਹੈਗੀਆਂ ਕਿ ਰਾਤ ਵੇਲੇ ਜਿਹੜੇ ਸ਼੍ਰੀ ਕ੍ਰਿਸ਼ਨ ਜੀ ਖੁਦ ਆ ਕੇ ਉੱਥੇ ਰਾਸ ਲੀਲਾ ਕਰਦੇ ਹੈ ਅਤੇ ਪਰ ਜਿਹੜੇ ਉੱਥੋਂ ਦੇ ਬਾਂਦਰ ਵੀ ਹੈ ਉਹ ਵੀ ਸ਼ਾਮ ਵਾਲੇ ਆਪਣੇ ਘਰਾਂ 'ਚ ਜਾਣਾ ਸ਼ੁਰੂ ਕਰ ਦਿੰਦੇ ਆ ਕਿਉਂਕਿ ਸ਼ਾਮ ਤੱਕ ਸਾਰਾ ਉਹ ਕਹਿੰਦੇ ਕਿ ਜੰਗਲ ਖਾਲੀ ਕਰਨਾ ਹੁੰਦਾ ਉਹ ਨਿਧੀ ਵਨ ਉਹਨਾਂ ਨੇ ਅਤੇ ਕੋਈ ਵੀ ਉੱਥੇ ਇੱਕ ਸਿੰਗਲ ਬੰਦਾ ਵੀ ਨਹੀਂ ਰਹਿ ਜਾਂਦਾ ਅਤੇ ਸਾਰਾ ਉਹਨਾਂ ਨੇ ਕਪਾਟ ਬੰਦ ਕਰਨੇ ਹੁੰਦੇ ਆ ਫਿਰ ਉਹਨਾਂ ਦੇ ਜਿਹੜੇ ਚੁਰਾਸੀ ਪਿੱਲਰ ਜਿਹੜੇ ਹੋਰ ਰਾਧਾ ਰਮਨ ਮੰਦਿਰ ਹੋਰ ਸਾਰਾ ਮੰਦਰ ਦੇਖ ਕੇ ਹਰ ਜਗ੍ਹਾ 'ਤੇ ਮੈਂ ਦੇਖਿਆ ਕਿ ਉੱਥੇ ਰਾਧਾ ਰਾਧਾ ਰਾਧੇ ਰਾਧੇ ਹੀ ਕਰਦੇ ਆ ਔਰ ਦੇਖ ਕੇ ਇੰਨਾਂ ਕੁ ਜ਼ਿਆਦਾ ਅੱਛਾ ਲੱਗਾ ਕਿ ਸਾਰੇ ਹੀ ਲੋਕ ਉੱਥੇ ਬੜੇ ਹੀ ਭਗਤੀ ਰੰਗ 'ਚ ਡੁੱਬੇ ਹੋਏ ਨੇ ਅਤੇ ਆ ਕੇ ਵੀ ਤੁਸੀਂ ਮਹਿਸੂਸ ਕਰਦੇ ਹੋ ਕਿ ਉਹ ਉੱਥੇ ਜਿਸ ਵੇਲੇ ਤੁਸੀਂ ਵਰਿੰਦਾਵਨ ਤੋਂ ਆ ਵੀ ਜਾਂਦੇ ਹੋ ਅਤੇ ਫਿਰ ਵੀ ਤੁਸੀਂ ਉਹਦੇ ਰੰਗ 'ਚ ਰੰਗੇ ਰਹਿੰਦੇ ਅਤੇ ਮੈਨੂੰ ਬਹੁਤ ਅੱਛਾ ਲੱਗਦਾ ਮੇਰਾ ਜੀ ਕਰਦਾ ਬਾਰ ਬਾਰ ਜਾਵਾਂ ਉੱਥੇ